ਇੱਕ ਨਵ ਜੰਮੇ ਬੱਚੇ ਨੂੰ ਸਵੱਛ ਵਾਤਾਵਰਣ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਅਤੇ ਇਸ ਇਵ ਲਈ ਵੀ ਜਰੂਰੀ ਹੈ ਕਿ ਉਹ ਬੱਚਾ ਸਿਹਤਮੰਦ ਹੋਵੇ ਭਾਰਤ ਵਿੱਚ ਬਹੁਤ ਸਾਰੀ ਗਰੀਬੀ ਹੋਣ ਕਰਕੇ ਕਈ ਬੱਚੇ ਸਵੱਚ ਵਾਤਾਵਰਨ ਤੋਂ ਵਾਂਝੇ ਰਹਿ ਜਾਂਦੇ ਹਨ ਉਹਨਾਂ ਵਾਸਤੇ ਜੋ ਸਰਕਾਰਾਂ ਨੂੰ ਇਹ ਲੋੜ ਹੈ ਕਿ ਉਹ ਉਹਨਾਂ ਨੂੰ ਇਹ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਉਹਨਾਂ ਨੂੰ ਰਹਿਣ ਸਹਿਣ ਵਾਸਤੇ ਸਾਫ਼ ਸੁਥਰੇ ਘਰਾਂ ਦਾ ਪ੍ਰਬੰਧ ਕੀਤਾ ਜਾਵੇ ਸਾਫ਼ ਕਲੋਨੀਆਂ ਦਿੱਤੀਆਂ ਜਾਣ ਜਿੱਥੇ ਉਹ ਬਿਮਾਰ ਨਾ ਹੋਣ ਝੁੱਗੀ ਝੌਪੜੀਆਂ ਵਿੱਚ ਵੀ ਸਫਾਈਆਂ ਦੇ ਪ੍ਰਬੰਧ ਹੋਣੇ ਚਾਹੀਦੇ ਤਾਂ ਕਿ ਜੋ ਨਵੇਂ ਬੱਚੇ ਜੰਮਦੇ ਹਨ ਉਹ ਬਿਮਾਰੀਆਂ ਦਾ ਜੰਮਦੇ ਸਾਰ ਸ਼ਿਕਾਰ ਨਾ ਹੋਣ ਉਹਨਾਂ ਵਿੱਚੋਂ ਕਈ ਲੋਕ ਪੋਲੀਓ ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਸ਼ਿਕਾਰ ਹੋ ਜਾਂਦੇ ਹਨ ਭਾਰਤ ਸਰਕਾਰ ਵੱਲੋਂ ਪੋਲੀਓ ਦੇ ਖਿਲਾਫ ਇੱਕ ਮੁਹਿੰਮ ਚਲਾ ਕੇ ਇਹਨੂੰ ਕਾਫ਼ੀ ਰੋਕਣ ਦਾ ਯਤਨ ਕੀਤਾ ਗਿਆ ਹੈ ਇਸ ਤਰੀਕੇ ਦੇ ਨਾਲ ਨਵੇਂ ਜਨਮੇ ਬੱਚਿਆਂ ਦੀਆਂ ਸਿਹਤ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਨਵੇਂ ਉਪਰਾਲੇ ਕਰਨ ਦੀ ਬਹੁਤ ਲੋੜ ਹੈ ਉਹਨਾਂ ਨੂੰ ਡਾਕਟਰੀ ਸਹੂਲਤਾਂ ਸਿਹਤ ਸਹੂਲਤਾਂ ਉਹਨਾਂ ਦੇ ਥਾਵਾਂ ਉੱਪਰ ਪਹੁੰਚਾਉਣ ਦੀ ਬਹੁਤ ਜ਼ਰੂਰਤ ਹੈ ਜਿੰਨੀ ਬੱਚਿਆਂ ਵਾਸਤੇ ਐਜੂਕੇਸ਼ਨ ਜ਼ਰੂਰੀ ਹੈ ਉੰਨਾ ਹੀ ਉਹਨਾਂ ਦੇ ਵਾਸਤੇ ਜੋ ਘਰੇਲੂ ਹਾਲਾਤ ਹਨ ਉਹ ਵੀ ਕਾਰਗਾਰ ਹੋਣੇ ਚਾਹੀਦੇ ਹਨ ਔਰ ਉਹਨਾਂ ਦੇ ਮਾਪਿਆਂ ਵਿੱਚ ਇਹ ਚੇਤਨਾ ਭਰਨ ਦੀ ਵੀ ਲੋੜ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਾਫ਼ ਸੁਥਰੇ ਵਾਤਾਵਰਨ ਸਾਫ਼ ਸੁਥਰੇ ਕੱਪੜਿਆਂ ਦੇ ਵਿੱਚ ਰੱਖਣ ਅਤੇ ਕੱਪੜਿਆਂ ਨੂੰ ਸਾਫ਼ ਸੁਥਰੇ ਕਰਨ ਦੇ ਵਾਸਤੇ ਉਹਨਾਂ ਨੂੰ ਲੋੜੀਂਦੀਆਂ ਸਹੂਲਤਾਂ ਵੀ ਪ੍ਰਦਾਨ ਕਰਵਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ